ਸਾਡੀ ਰਸੋਈ ਵਿੱਚ ਬਿਜਲੀ ਦੇ ਬਹੁਤ ਪ੍ਰਕਾਰ ਦੇ ਉਪਕਰਣ ਹਨ ਜਿਵੇਂ ਕਿ ਕੌਫੀ ਬਣਾਉਣ ਵਾਲੀ ਮਸ਼ੀਨ ਓਵਨ ਮਾਈਕਰੋਵੇ ਫਰਿੱਜ ਪਾਣੀ ਵਾਲਾ ਆਰ ਓ ਆਦਿ ਪੁਰਾਣੇ ਦਿਨਾਂ ਨਾਲੋਂ ਇਸਦਾ ਤਜਰਬਾ ਬਹੁਤ ਹੀ ਵੱਖਰਾ ਹੈ ਕਿਉਂਕਿ ਪੁਰਾਣੇ ਸਮੇਂ ਵਿੱਚ ਇਹ ਉਪਲਲੱਬਧ ਨਹੀਂ ਹੁੰਦੇ ਸਨ ਪੁਰਾਣੇ ਸਮੇਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਨ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ ਜਿਸ ਕਾਰਣ ਬਹੁਤ ਸਮਾਂ ਬਰਬਾਦ ਹੁੰਦਾ ਸੀ ਜਦੋਂ ਕਿ ਇਸ ਤੋਂ ਉਲਟ ਅੱਜ ਇਹ ਉਪਕਰਣ ਉਪਲੱਬਧ ਹੋਣ ਕਰਕੇ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਨ ਵਿੱਚ ਵੀ ਬਹੁਤ ਆਸਾਨੀ ਹੁੰਦੀ ਹੈ ਅੱਜ ਦੇ ਸਮੇ 'ਚ ਮਿਕਸਰ ਗਿਰਿੰਦਰ ਆਦਿ ਹੋਣ ਕਰਕੇ ਮਸਾਲਾ ਆਦਿ ਪੀਸਣ ਵਿੱਚ ਬਹੁਤ ਆਸਾਨੀ ਹੁੰਦੀ ਹੈ ਜਦਕਿ ਪੁਰਾਣੇ ਸਮੇਂ ਵਿੱਚ ਦੋਹਰੀ ਸੋਟਾ ਆਦਿ ਹੁੰਦੇ ਸਨ ਮਸਾਲੇ ਪੀਸਣ ਵਿੱਚ ਬਹੁਤ ਹੀ ਸਮਾਂ ਲੱਗ ਜਾਂਦਾ ਸੀ ਪੁਰਾਣੇ ਦਿਨਾਂ ਨਾਲੋਂ ਇਸ ਦਾ ਤਜਰਬਾ ਬਹੁਤ ਹੀ ਵੱਖਰਾ ਹੈ ਇਹਨਾਂ ਉਪਕਰਣਾ ਦੇ ਆਉਣ ਨਾਲ ਸਾਡੀ ਅੱਜ ਦੀ ਜ਼ਿੰਦਗੀ ਬਹੁਤ ਹੀ ਆਸਾਨ ਅਤੇ ਰਫ਼ਤਾਰ ਵਾਲੀ ਹੋ ਗਈ ਹੈ ਪਰ ਇਹਨਾਂ ਚੀਜ਼ਾਂ ਦੇ ਕਾਰਣ ਸਾਡੀ ਪੁਰਾਣੀ ਜ਼ਿੰਦਗੀ ਵਾਲੇ ਲੁਫ਼ਤ ਖਤਮ ਹੁੰਦੇ ਜਾ ਰਹੇ ਹਨ ਅੱਜ ਵਾਸ਼ਵਿਸ਼ਨ ਹੋਣ ਕਰਕੇ ਲੋਕ ਭਾਂਡੇ ਆਦਿ ਆਪਣੀ ਰਸੋਈ ਦੇ ਅੰਦਰ ਹੀ ਮਿੰਟਾਂ ਵਿੱਚ ਧੋ ਲੈਂਦੇ ਹਨ ਗੈਸ ਸਲੰਡਰ ਦੇ ਆਉਣ ਨਾਲ ਸਾਡੀ ਜ਼ਿੰਦਗੀ ਬਹੁਤ ਹੀ ਆਸਾਨ ਹੋ ਗਈ ਹੈ ਜਿਹਨਾਂ ਚੀਜ਼ਾਂ ਨੂੰ ਗੈਸ ਉੱਪਰ ਬਣਾਉਣ ਵਿੱਚ ਇੰਨਾਂ ਸਮਾਂ ਨਹੀਂ ਲੱਗਦਾ ਜਦਕਿ ਚੁੱਲ੍ਹੇ ਦੇ ਉੱਪਰ ਬਣਾਈਆਂ ਜਾਂਦੀਆਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ ਗੈਸ ਚੁੱਲ੍ਹਿਆਂ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਰਫ਼ਤਾਰ ਲਿਆਂਦੀ ਹੈ ਪਹਿਲਾਂ ਪਹਿਲਾਂ ਲੋਕਾਂ ਕੋਲ ਕੌਫੀ ਏ ਆਦਿ ਬਣਾਉਣ ਦੇ ਸਾਧਨ ਨਹੀਂ ਹੁੰਦੇ ਸਨ ਅੱਜ ਅੱਜ ਦੇ ਜਮਾਨੇ ਵਿੱਚ ਕੌਫੀ ਦੀਆਂ ਮਸ਼ੀਨਾਂ ਆਉਂਦੀਆਂ ਹਨ ਜਿਸ ਕਾਰਣ ਲੋਕ ਆਸਾਨੀ ਨਾਲ ਅਤੇ ਜਲਦੀ ਵਿੱਚ ਕੌਫੀ ਤਿਆਰ ਕਰ ਲੈਂਦੇ ਹਨ ਅੱਜ ਕੱਲ੍ਹ ਸੈਂਡਵਿਚ ਬਣਾਉਣ ਵਾਲੀਆਂ ਮਸ਼ੀਨਾਂ ਵੀ ਉਪਲੱਬਧ ਹਨ ਸੈਂਡਵਿਚ ਮੇਖ ਇਹਨਾਂ ਦੀ ਆਸਾਨੀ ਨਾਲ ਵਰਤੋਂ ਕੀਤੀ ਜਾ ਸਕ ਜਾ ਸਕਦੀ ਹੈ ਇਹਨਾਂ ਸਾਧਨਾਂ ਦੇ ਆਉਣ ਨਾਲ ਸਾਡੀ ਜ਼ਿੰਦਗੀ ਬਹੁਤ ਜ਼ਿਆਦਾ ਬਦਲ ਗਈ ਹੈ ਸਾਡੀ ਜ਼ਿੰਦਗੀ ਬਹੁਤ ਤੇਜ਼ ਰਫ਼ਤਾਰ ਵਾਲੀ ਹੋ ਗਈ ਹੈ ਪੁਰਾਣੇ ਸਮੇਂ ਵਿੱਚ ਇਹ ਸਭ ਚੀਜ਼ਾਂ ਉਪਲੱਬਧ ਨਾ ਹੋਣ ਕਰਕੇ ਚੀਜ਼ਾਂ ਨੂੰ ਤਿਆਰ ਕਰਨ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ